ਅਸੀਂ ਆਮ ਤੌਰ 'ਤੇ ਇਹਨਾਂ ਮੁਸ਼ਕਲਾਂ ਨੂੰ ਘਟਾਉਣ ਲਈ ਜਦੋਂ ਅਸੀਂ ਕਿਤੇ ਯਾਤਰਾ 'ਤੇ ਜਾਣਾ ਹੋਵੇ ਤਾਂ ਅਸੀਂ ਸਭ ਤੋਂ ਪਹਿਲਾਂ ਇਹ ਧਿਆਨ ਰੱਖਦੇ ਹਾਂ ਕਿ ਸਾਨੂੰ ਅਸੀਂ ਜਿਸ ਸਾਧਨ 'ਤੇ ਜਾਣਾ ਹੈ ਕੀ ਉਹ ਸਹੀ ਹੈ ਅਸੀਂ ਸਭ ਤੋਂ ਪਹਿਲਾਂ ਤਿਆਰ ਹੁੰਦੇ ਹਾਂ ਤਿਆਰ ਹੋ ਕੇ ਅਸੀਂ ਜਿਸ ਵਹੀਕਲ 'ਤੇ ਜਾਣਾ ਹੋਵੇ ਉਸ ਨੂੰ ਚੈੱਕ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਜਦੋਂ ਘਰੋਂ ਤੁਰਦੇ ਹਾਂ ਜਾਂ ਤੁਰਨ ਵੇਲ਼ੇ ਅਸੀਂ ਟਾਇਮ ਨੋਟ ਕਰਦੇ ਹਾਂ ਕਿ ਅਸੀਂ ਲੇਟ ਤਾਂ ਨਹੀਂ ਹੋ ਜਾਵਾਂਗੇ ਜਾਂ ਜਿਸ ਸਾਧਨ 'ਤੇ ਜਾਣਾ ਹੈ ਉਹ ਸਾਧਨ ਦੀ ਉਡੀਕ ਕਰਾਂਗੇ ਜਾਂ ਉਸ ਤੋਂ ਪਹਿਲਾਂ ਜਾ ਕੇ ਉਸ ਜਗ੍ਹਾਂ 'ਤੇ ਜਾ ਕੇ ਖੜ੍ਹਾਂਗੇ ਅਤੇ ਸਾਨੂੰ ਜਿਸ ਜਿਸ ਚੀਜ਼ ਦੀ ਲੋੜ ਹੈ ਜਿੱਦਾਂ ਖਾਣ ਪੀਣ ਦੀ ਵਸਤੂ ਦੀ ਲੋੜ ਹੈ ਅਸੀਂ ਆਪਣੇ ਘਰ ਤੋਂ ਉਹ ਵਸਤਾਂ ਤਿਆਰ ਕਰਕੇ ਲੈ ਕੇ ਜਾਵਾਂਗੇ ਜੇਕਰ ਉਹ ਫਿਰ ਵੀ ਸਾਡੇ ਕੋਲ਼ ਕਿਸੇ ਸਮਾਨ ਦੀ ਕਮੀ ਪੈਂਦੀ ਹੈ ਜਾਂ ਖਾਣ ਪੀਣ ਦੀ ਕਮੀ ਪੈਂਦੀ ਹੈ ਤਾਂ ਅਸੀਂ ਕਿਸੇ ਰਸਤੇ ਵਿੱਚ ਜਾ ਕੇ ਕਿਸੇ ਵਧੀਆ ਢਾਬੇ 'ਤੇ ਜਾ ਕੇ ਰੁਕ ਕੇ ਅਸੀਂ ਉਹ ਸਮਾਨ ਪੈਕ ਕਰਵਾਵਾਂਗੇ ਉਸ ਤੋਂ ਬਾਅਦ ਅਸੀਂ ਉਸ ਖਾਣ ਵਾਲਾ ਸਮਾਨ ਵੇਖਾਂਗੇ ਕਿ ਉਹ ਸਾਡੇ ਸਿਹਤ ਲਈ ਕੋਈ ਹਾਨੀਕਾਰਕ ਤਾਂ ਨਹੀਂ ਹੈ ਅਤੇ ਅਸੀਂ ਸਭ ਤੋਂ ਜ਼ਰੂਰੀ ਪੈਸੇ ਦਾ ਪ੍ਰਬੰਧ ਰੱਖਾਂਗੇ ਕਿ ਸਾਡੇ ਜੋ ਵੀ ਸਾਡੇ ਬਾਹਰ ਆਉਣ ਵਾਲੀ ਆਉਣ ਵਾਲੀ ਖਾਣ ਵਾਲੀ ਚੀਜ਼ ਵਿੱਚ ਕੋਈ ਕਮੀ ਨਾ ਆਵੇ ਪਹਿਲਾਂ ਪੈਸੇ ਦਾ ਪ੍ਰਬੰਧ ਰੱਖਾਂਗੇ ਇਸ ਇਹ ਸਾਡੀਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਘਟਾਉਣ ਦੇ ਵਿੱਚ ਸਾਡੇ ਸਾਡੇ ਲਈ ਇੱਕ ਲਾਭਦਾਇਕ ਹੁੰਦਾ ਹੈ